ਮੈਂ ਸਕੂਲ ਅਤੇ ਜੋਨਲ ਅਤੇ ਡਿਸਟਿਕ ਮੁਕਾਬਲਿਆਂ ਦੇ ਵਿੱਚ ਰੀਲੇਅ ਰੇਸ ਦੇ ਵਿੱਚ ਭਾਗ ਲਿਆ ਹੈ ਅਤੇ ਕਈ ਮੈਡਲ ਵੀ ਜਿੱਤੇ ਹਨ ਰੀਲੇਅ ਦੋ ਪ੍ਰਕਾਰ ਦੀ ਹੁੰਦੀ ਹੈ ਚਾਰ ਇੰਨਟੂ ਸੌ ਅਤੇ ਚਾਰ ਇੰਨਟੂ ਚਾਰ ਸੌ ਮੀਟਰ ਦੀ ਇਹਦੇ ਵਿੱਚ ਟੀਮ ਦੇ ਨਾਲ ਅਸੀਂ ਸ਼ਾਮਲ ਹੁੰਦੇ ਹਾਂ ਚਾਰ ਜਣੇ ਹੁੰਦੇ ਹਨ ਜੋ ਕਿ ਸੌ ਸੌ ਮੀਟਰ ਜਾਂ ਫਿਰ ਚਾਰ ਚਾਰ ਸੌ ਮੀਟਰ ਇੱਕ ਜਣਾ ਭੱਜਦਾ ਹੈ ਅਤੇ ਹੱਥ ਦੇ ਵਿੱਚ ਡੰਡੀ ਫੜਕੇ ਭੱਜਣਾ ਹੁੰਦਾ ਹੈ ਅਤੇ ਅਗਲੇ ਆਪਣੇ ਟੀਮ ਮੈਂਬਰ ਨੂੰ ਫੜਾਉਣੀ ਹੁੰਦੀ ਹੈ ਜਿਹੜਾ ਕਿ ਇੱਕ ਹੋਰ ਸੌ ਮੀਟਰ ਜਾਂ ਫਿਰ ਚਾਰ ਸੌ ਮੀਟਰ ਜਿਸ ਤਰ੍ਹਾਂ ਦੀ ਰੇਸ ਹੈ ਉਵੇਂ ਉਹ ਡਿਸਟੇਸ਼ ਕਵਰ ਕਰਦਾ ਹੈ ਆਪਣੇ ਸਕੂਲ ਦੇ ਵਿੱਚ ਮੈਂ ਬਾਰਵੀਂ ਜਮਾਤ ਦੇ ਵਿੱਚ ਗੋਲਡ ਮੈਂਡਲ ਜਿੱਤਿਆ ਹਾਂ ਚਾਰ ਇੰਨਟੂ ਸੌ ਮੀਟਰ ਦੀ ਰੇਸ ਦੇ ਵਿੱਚ ਅਤੇ ਡਿਸਟਿਕ ਲੈਵਲ ਦੇ ਵਿੱਚ ਅਸੀਂ ਚਾਰ ਇੰਨਟੂ ਚਾਰ ਸੌ ਮੀਟਰ ਦੀ ਰੇਂਸ ਦੇ ਵਿੱਚ ਸਿਲਵਰ ਮੈਂਡਲ ਜਿੱਤਿਆ ਹੈ